ਸਾਡੇ ਖੇਤਰ ਵਿੱਚ ਕਲਾ ਅਤੇ ਸ਼ਿਲਪਕਾਰੀ ਖੇਤਰ ਰਾਜ ਦੀ ਸੱਭਿਆਚਾਰਿਕ ਪਹਿਚਾਣ ਅਤੇ ਵਿਰਾਸਤ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਉਂਦੇ ਹਨ ਜਿਵੇਂ ਕਿ ਆਰਟਸ ਫਾਈਨ ਆਰਟਸ ਡਰਾਇੰਗ ਇਹ ਸਾਰੀਆਂ ਹੀ ਸ਼ਿਲਪਕਾਰੀ ਦੇ ਵਿੱਚ ਆ ਜਾਂਦੀਆਂ ਹਨ ਇਹ ਸਾਰੀਆਂ ਬਹੁਤ ਜ਼ਿਆਦਾ ਹੀ ਸਾਡੇ ਸਮਾਜ ਦੇ ਵਿੱਚ ਯੋਗਦਾਨ ਪਾਉਂਦੀਆਂ ਹਨ ਅਤੇ ਅਸੀਂ ਇਸ ਤਰ੍ਹਾਂ ਇਹਨਾਂ ਨੂੰ ਸੰਭਾਲ ਕੇ ਰੱਖ ਸਕਦੇ ਹਾਂ